ਹੈਲੋ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਜੀ ਮੈਂ ਵਧੀਆ ਦੇ ਵਿੱਚੋਂ ਮੈਂ ਨਾ ਮੈਂ ਕਿਹਾ ਮੈਂ ਨਿਊਜ਼ਪੇਪਰ 'ਚ ਤੁਹਾਡੀ ਐਡ ਦੇਖੀ ਹੈ ਅਕੈਡਮੀ ਦੀ ਤੁਸੀਂ ਬੱਚਿਆਂ ਨਾਲ ਐਕਟਿਵੀਟੀਸ ਕਰਵਾਉਂਦੇ ਹੋ ਅਤੇ ਤੁਸੀਂ ਕਿਹੜੀ ਕਿਹੜੀ ਐਕਟੀਵਿਟੀ ਕਰਵਾਉਂਦੇ ਹੋ ਬੱਚਿਆਂ ਨੂੰ ਐਕਚੁਲੀ ਮੇਰਾ ਬੱਚਾ ਨਾ ਡਾਂਸ ਸਿੱਖਣਾ ਅਤੇ ਡਾਂਸ ਸਿਖਾਉਂਦੇ ਹੋ ਬੱਚਿਆਂ ਨੂੰ ਹਾਂ ਅਤੇ ਡਾਂਸ ਦੇ ਨਾਲ ਹੋਰ ਕਿਹੜੀ ਕਿਹੜੀ ਐਕਟੀਵਿਟੀਜ਼ ਕਰਵਾਉਂਦੇ ਹੋ ਹਾਂਜੀ ਅਤੇ ਤੁਹਾਡੀ ਅਕੈਡਮੀ ਵਧੀਆ ਹਾਂਜੀ ਅਤੇ ਤੁਹਾਡੀ ਅਕੈਡਮੀ ਵਧੀਆ ਹੋਰ ਫੀਸ ਫੀਸ ਦਾ ਕੀ ਹਿਸਾਬ ਹੈ

ਹਾਂਜੀ ਅਤੇ ਫੀਸ ਕਿੰਨੀ ਕੁ ਹੋਏਗੀ ਜੀ ਠੀਕ ਆ ਹਾ ਹੋਰ ਬੱਚਿਆਂ ਨੂੰ ਮੈਡਲ ਵਗੈਰਾ ਦਿੱਤੇ ਜਾਣਗੇ ਹਾਂਜੀ ਅਤੇ ਫਿਰ ਹੋਰ ਡਾਂਸ ਦੇ ਨਾਲ ਖੇਡਾਂ ਵਗੈਰਾ ਵੀ ਕਰਵਾਉਂਦੇ ਹੋਣਗੇ ਠੀਕ ਹਾਂਜੀ ਹਾਂਜੀ ਠੀਕ ਹੈ ਮੈਮ ਮੈਂ ਫੇਰ ਕਿੱਥੇ ਵਿਜਿਟ ਕਰਨਾ ਚਾਹੀਦਾ ਮੈਨੂੰ ਲੋਕੇਸ਼ਨ 'ਤੇ ਹੀ ਹਾਂਜੀ ਹਾਂਜੀ ਠੀਕ ਹੈ ਤੁਸੀਂ ਮੈਨੂੰ ਨਾ ਸਾਰੇ ਡਾਕੂਮੈਂਟ ਜਿਹੜੇ ਆ ਉਹ ਵਟਸਐਪ ਅਤੇ ਸੈਂਡ ਕਰ ਦਿਓ ਅਤੇ ਮੈਂ ਲੈ ਕੇ ਆਉਂਦਾ ਹਾਂਜੀ ਠੀਕ ਹੈ ਫਿਰ ਤੁਸੀਂ ਮੈਨੂੰ ਸੈਂਡ ਕਰ ਦਿਓ ਅਤੇ ਮੈਂ ਆ ਜਾਵਾਂਗੀ